ਮੈਂ ਰਾਜਕੁਮਾਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਅੱਜ ਸ਼ਰਾਬ ਸਿਗਰਟ ਅਤੇ ਨਸ਼ਿਆਂ ਬਾਰੇ ਨੌਜਵਾਨਾਂ ਬਾਰੇ ਦੱਸਿਆ ਗਿਆ ਹੈ ਕਿ ਸ਼ਰਾਬ ਨੌਜਵਾਨ ਪੀੜ੍ਹੀ ਅੱਜ ਦੇ ਨਸ਼ਿਆਂ ਵਿੱਚ ਡੁੱਬਦੀ ਹੀ ਜਾ ਰਹੀ ਹੈ ਜਿਵੇਂ ਕਿ ਕਈ ਸ਼ਰਾਬ ਦਾ ਨਸ਼ਾ ਕਰਦੇ ਹਨ ਕੋਈ ਸਿਗਰਟ ਪੀਂਦਾ ਜਾਂ ਕੋਈ ਗਲਤ ਨਸ਼ਾ ਕਰਦਾ ਹੈ ਉਸ ਨਾਲ ਉਹਦੀ ਸਿਹਤ ਨੂੰ ਕਾਫੀ ਫਰਕ ਪੈਂਦਾ ਹੈ ਜਿਵੇਂ ਕਿ ਸ਼ਰਾਬ ਪੀ ਕੇ ਕਈ ਬੰਦੇ ਡਿੱਗੇ ਹੋਣਗੇ ਰੋਡ 'ਤੇ ਉਸਦੇ ਮਾਪਿਆਂ ਨੂੰ ਕਿੰਨਾ ਦੁੱਖ ਲੱਗਦਾ ਕਿ ਸਾਡਾ ਪੁੱਤਰ ਨਸ਼ਾ ਕਰ ਰਿਹਾ ਹੈ ਜੇਕਰ ਦੇਖੀਏ ਤਾਂ ਨਸ਼ਿਆਂ ਵਿੱਚ ਡੁੱਬ ਰਹੇ ਨੌਜਵਾਨਾਂ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਨਸ਼ਾ ਸਾਡੀ ਸਿਹਤ ਲਈ ਬਹੁਤ ਹੀ ਮਾੜਾ ਹੈ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਅਤੇ ਹੋਰ ਲੋਕਾਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਨਸ਼ਾ ਕਰਨ 'ਤੇ ਕਾਫੀ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਵਿੱਚ ਕਿ ਜਿਵੇਂ ਕਈ ਸ਼ਰਾਬ ਪੀ ਕੇ ਐਨ ਜਾਂ ਕਈਆਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ ਪਰ ਜੇਕਰ ਅਸੀਂ ਨਸ਼ਾ ਨਹੀਂ ਕਰਾਂਗੇ ਤਾਂ ਸਾਡਾ ਪਰਿਵਾਰ ਵੀ ਸੁਖੀ ਹੋਵੇਗਾ ਅਤੇ ਨੌਜਵਾਨ ਪੀੜ੍ਹੀ ਅਸੀਂ ਸੰਕਲਪ ਕਰੀਏ ਕਿ ਅੱਜ ਤੋਂ ਬਾਅਦ ਅਸੀਂ ਨਸ਼ਾ ਨਹੀਂ ਕਰਾਂਗੇ ਜੇਕਰ ਅਸੀਂ ਨਸ਼ਾ ਨਹੀਂ ਕਰਾਂਗੇ ਤਾਂ ਹੀ ਆਪਣਾ ਦੇਸ਼ ਵਿੱਚ ਆਪਣਾ ਨਾਂ ਰੋਸ਼ਨ ਕਰਵਾ ਸਕਦੇ ਹਾਂ ਅਤੇ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾ ਸਕਦੇ ਹਾਂ